ਹਾਂਜੀ ਅਸੀਂ ਸਵੇਰੇ ਅਤੇ ਸ਼ਾਮ ਨੂੰ ਦੌੜਦੇ ਹਾਂ ਦੌੜਦੇ ਹਾਂ ਅਸੀਂ ਦੋ ਘੰਟੇ ਸਵੇਰੇ ਅਤੇ ਦੋ ਘੰਟੇ ਸ਼ਾਮ ਨੂੰ ਦੌੜਦੇ ਹਾਂ ਅਤੇ ਸਾਨੂੰ ਬਹੁਤ ਹੀ ਵਧੀਆ ਲੱਗਦਾ ਹੈ ਦੌੜਨ ਦਾ ਜੇ ਅਸੀਂ ਦ ਦੌੜਨ ਨਾਲ਼ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਸਰੀਰ ਨੂੰ ਐਨ ਫਿੱਟ ਲੱਗਦਾ ਹੈ ਸਰੀਰ ਫਿੱਟ ਫਿੱਟ ਲੱਗਦਾ ਹੈ ਅਤੇ ਖੁਸ਼ੀ ਮਿਲਦੀ ਹੈ ਦਿਮਾਗ਼ ਤੰਦਰੁਸਤ ਰਹਿੰਦਾ ਹੈ ਅਤੇ ਸਰੀਰ ਵਿੱਚ ਚੁਸਤੀ ਫੁਰਤੀ ਆਉਂਦੀ ਹੈ ਕੰਮ ਕਰਨ ਦੀ ਵੀ ਸ਼ਕਤੀ ਮਿਲਦੀ ਹੈ ਅਤੇ ਐਂਹੀ ਲੱਗਿਆ ਰਹਿੰਦਾ ਹੈ ਕਿ ਸ਼ਾਮ ਨੂੰ ਵੀ ਦੌੜਨਾ ਹੈ ਅਤੇ ਸੁਬਹਾ ਵੀ ਦੌੜਨਾ ਹੈ ਸਾਨੂੰ ਬਹੁਤ ਚੰਗਾ ਲੱਗਦਾ ਹੈ ਦੌੜਨਾ ਖੁਸ਼ੀ ਮਿਲਦੀ ਹੈ ਮਨ ਨੂੰ ਮਨ ਨੂੰ ਇਹ ਹੁੰਦਾ ਹੈ ਕਿ ਹਾਂ ਆਪਾਂ ਛੇਤੀ ਕੰਮ ਨਿਬੇੜੀਏ ਅਤੇ ਆਪਣਾ ਕੰਮ ਕਰਨਾ ਹੈ ਅਤੇ ਮਹਿਸੂਸ ਨਹੀਂ ਹੁੰਦਾ ਸਰੀਰ ਸਾਰਾ ਫਿੱਟ ਰਹਿੰਦਾ ਲੱਤਾਂ ਬਾਹਵਾਂ ਨਹੀਂ ਦੁੱਖਦੀਆਂ ਜੀ ਸਭ ਕੁਛ ਵਧੀਆ ਅਤੇ ਵਧੀਆ ਹੁੰਦਾ ਜੋ ਆਪਣੇ ਸਰੀਰ ਨੂੰ ਤੰਦਰੁਸਤ ਰੱਖਦਾ ਹੈ ਉਹ ਹੈ ਆਪਣੀ ਦੌੜਨ ਦੀ ਸ਼ਕਤੀ ਅੱਜ ਅਸੀਂ ਦੋ ਕਿਲੋਮੀਟਰ ਦੌੜ ਸਕਦੇ ਹਾਂ ਅਤੇ ਕੱਲ੍ਹ ਨੂੰ ਜਿਵੇਂ ਆਪਾਂ ਰੋਜ਼ ਦੀ ਰੂਟੀਨ ਵਧਾਈਏ ਦਸ ਮਿੰਟ ਅੱਗੇ ਦੋ ਘੰਟੇ ਹੈ ਜਿਵੇਂ ਦਸ ਮਿੰਟ ਅੱਗੇ ਵਧਾ ਲੈਂਦੇ ਹਾਂ ਫਿਰ ਸ਼ਾਮ ਨੂੰ ਦਸ ਮਿੰਟ ਅੱਗੇ ਵਧਾ ਲੈਂਦੇ ਆ ਇਸ ਤਰ੍ਹਾਂ ਕਰਕੇ ਆਪਾਂ ਨਾਲ਼ ਹੋਰ ਨੂੰ ਵੀ ਆਸ ਪੜੌਸ ਨੂੰ ਵੀ ਜੋੜ ਸਕਦੇ ਹਾਂ ਕਿ ਸਰੀਰ ਫਿੱਟ ਦੇਖ ਕੇ ਅਗਲਾ ਕਹਿੰਦਾ ਹੈਗਾ ਵੀ ਹਾਂ ਅਸੀਂ ਵੀ ਭੱਜਣਾ ਹੈਗਾ ਨਾਲ਼ ਮੇਰੀਆਂ ਸਹੇਲੀਆਂ ਨੇ ਮੈਂ ਉਹਨਾਂ ਨੂੰ ਵੀ ਨਾਲ਼ ਜੋੜਦੀ ਹਾਂ ਕਿ ਆਜੋ ਆਪਾਂ ਭੱਜ ਕੇ ਆਈਏ ਸਵੇਰੇ ਦੋ ਘੰਟੇ ਭੱਜਦੇ ਹਾਂ ਅਤੇ ਸ਼ਾਮ ਨੂੰ ਵੀ ਦੋ ਘੰਟੇ ਦੌੜਦੇ ਹਾਂ ਜੀ ਅਸੀਂ ਸਾਨੂੰ ਬਹੁਤ ਬਹੁਤ ਅੱਛਾ ਲੱਗਦਾ ਮੇਰੀਆਂ ਫਰੈਂਡ ਨੇਗੀਆਂ ਦੋਸਤਾਂ ਸਹੇਲੀਆਂ ਨੇਗੀਆਂ ਜਿਹੜੀਆਂ ਉਹ ਵੀ ਮੇਰੇ ਨਾਲ਼ ਜਾਂਦੀਆਂ ਹਨ ਅਸੀਂ ਦੋ ਘੰਟੇ ਐਨ ਭੱਜਦੇ ਹਾਂ ਅਤੇ ਸਰੀਰ ਨੂੰ ਬਹੁਤ ਬਹੁਤ ਚੰਗਾ ਲੱਗਦਾ ਮੁੜਕਾ ਆਉਂਦਾ ਪਸੀਨਾ ਆਉਂਦਾ ਸਰੀਰ 'ਚ ਤੰਦਰੁਸਤੀ ਆਉਂਦੀ ਹੈ ਜੀ ਜਦੋਂ ਅਸੀਂ ਦੌੜਦੇ ਹਾਂ ਸਾਨੂੰ ਬਹੁਤ ਵਧੀਆ ਲੱਗਦਾ ਹੈ ਇਸ ਕਰਕੇ ਅਸੀਂ ਦੌੜਦੇ ਹਾਂ ਜੀ ਹਾਂਜੀ